ਰੇਡੀਓ ਸਟੇਸ਼ਨ ਐੱਫ ਐੱਮ 'ਤੇ ਮੈਨੂੰ ਪੰਜਾਬੀ ਸੁਣਨਾ ਬਹੁਤ ਪਸੰਦ ਹੈ ਮੈਂ ਰੇਡੀਓ 'ਤੇ ਪੰਜਾਬੀ ਵਿੱਚ ਸੁਰਤਾਲ ਚੈਨਲ ਸੁਣਦੀ ਹਾਂ ਮੈਨੂੰ ਰੇਡੀਓ ਸੁਣ ਕੇ ਬਹੁਤ ਜਾਣਕਾਰੀ ਪ੍ਰਾਪਤ ਹੁੰਦੀ ਹੈ ਰੇਡੀਓ 'ਤੇ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਬਠਿੰਡੇ ਸ਼ਹਿਰ ਦਾ ਹਾਲ ਚਾਲ ਦੱਸਿਆ ਜਾਂਦਾ ਹੈ ਉਸ ਵਿੱਚ ਸਾਡੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਕੋਲਿੰਗ ਕਰਦੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਸਨ ਸਾਨੂੰ ਸਮਾਜ ਵਿੱਚ ਵਿਚਰ ਰਿਹਾ ਸਭ ਕੁਛ ਪਤਾ ਲੱਗਦਾ ਹੈ ਕਿਸ ਜਗ੍ਹਾ 'ਤੇ ਸਾਨੂੰ ਜਾਣਾ ਚਾਹੀਦਾ ਹੈ ਅਤੇ ਕਿਸ ਜਗ੍ਹਾ ਸਾਨੂੰ ਨਹੀਂ ਜਾਣਾ ਚਾਹੀਦਾ ਹੈ ਇਹ ਸਾਨੂੰ ਰੇਡੀਓ ਰਾਹੀਂ ਪਤਾ ਲੱਗਦਾ ਹੈ ਰੇਡੀਓ ਰਾਹੀਂ ਦੂਰ ਦੂਰ ਦੀਆਂ ਖ਼ਬਰਾਂ ਸਾਡੇ ਤੱਕ ਘਰ ਪਹੁੰ ਸਾਡੇ ਤੱਕ ਆ ਜਾਂਦੀਆਂ ਹਨ ਅਸੀਂ ਘਰ ਬੈਠੇ ਰੇਡੀਓ ਸੁਣ ਸਕਦੇ ਹਾਂ ਰੇਡੀਓ ਸਾਡੇ ਲਈ ਇੱਕ ਮਨੋਰੰਜਨ ਦਾ ਸਾਧਨ ਵੀ ਹੈ ਅਸੀਂ ਆਪਣਾ ਕੋਈ ਕੰਮ ਕਰਦੇ ਵੀ ਆਪਣੇ ਕੋਲ ਰੇਡੀਓ ਰੱਖ ਲੈਂਦੇ ਹਾਂ ਅਤੇ ਰੇਡੀਓ 'ਤੇ ਆਪਣਾ ਪਸੰਦੀਦਾ ਚੈਨਲ ਸੁਣ ਸਕਦੇ ਹਾਂ ਸਾਨੂੰ ਮੈਨੂੰ ਮੈਂ ਮੈਨੂੰ ਉਨ੍ਹਾਂ ਦੀ ਅਵਾਜ਼ ਸੁਣਨੀ ਬਹੁਤ ਚੰਗੀ ਲੱਗਦੀ ਹੈ ਉਨ੍ਹਾਂ ਦੀ ਅਵਾਜ਼ ਸੁਣ ਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਹੈ ਟੀ ਵੀ 'ਤੇ ਅਸੀਂ ਆਪਣਾ ਮਨਪਸੰਦ ਚੈਨਲ ਦੇਖਦੇ ਹਾਂ ਟੀ ਵੀ 'ਤੇ ਵੀ ਮੈਂ ਪੰਜਾਬੀ ਚੈਨਲ ਦੇਖਦੀ ਹਾਂ ਉਸ 'ਤੇ ਸਾਨੂੰ ਪੰਜਾਬੀ ਫ਼ਿਲਮਾਂ ਪੰਜਾਬੀ ਸੀ ਨਾਟਕ ਦਿਖਾਏ ਜਾਂਦੇ ਹਨ ਉਨ੍ਹਾਂ ਨਾਲ ਸਾਡਾ ਮਨੋਰੰਜਨ ਵੀ ਹੁੰਦਾ ਹੈ ਅਤੇ ਸਾਨੂੰ ਸਿੱਖਿਆ ਵੀ ਮਿਲਦੀ ਹੈ ਬਹੁਤ ਸਾਰੇ ਨਾਟਕ ਅਜਿਹੇ ਹੁੰਦੇ ਹਨ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਅਤੇ ਸਾਡਾ ਮਨੋਰੰਜਨ ਹੁੰਦਾ ਹੈ